ਚੌਵੀ ਅਗਸਤ ਦੋ ਹਜ਼ਾਰ ਪੰਜ ਅਠਾਰਾਂ ਜੁਲਾਈ ਦੋ ਹਜ਼ਾਰ ਸੱਤ ਇੱਕ ਅਕਤੂਬਰ ਦੋ ਹਜ਼ਾਰ ਬਾਰਾਂ ਸੌਲਾਂ ਅਕਤੂਬਰ ਉੱਨੀ ਸੌ ਅਠਾਸੀ ਸੱਤ ਫਰਵਰੀ ਦੋ ਹਜ਼ਾਰ ਚੌਵੀ